ਮੈਂ ਬੁਣਾਈ ਬਹੁਤ ਕਰਦੀ ਹਾਂ ਮੈਂ ਹਰ ਨਾਪ ਦੇ ਸਵੈਟਰ ਬੁਣਦੀ ਹਾਂ ਮੈਂ ਆਨਲਾਈਨ ਵੀ ਬਹੁਤ ਕੁਛ ਸਿੱਖਦੀ ਹਾਂ ਮੈਨੂੰ ਉੱਥੋਂ ਨਾਪ ਦਾ ਪਤਾ ਲੱਗਦਾ ਹੈ ਔਰ ਕਿੰਨੇ ਜੋੜ ਪਾਣੇ ਹਨ ਉਹ ਪਤਾ ਲੱਗਦਾ ਹੈ ਨਮੂਨੇ ਵੀ ਬੜੇ ਸਿੱਖਦੀ ਹਾਂ ਔਰ ਉਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰਦੀ ਹਾਂ ਮੈਨੂੰ ਇੰਨਾ ਆਰਾਮ ਹੋ ਗਿਆ ਹੈ ਜਦੋਂ ਦਾ ਇਹ ਆਨਲਾਈਨ ਸਿੱਖਿਆ ਸ਼ੁਰੂ ਹੋਈ ਹੈ ਮੇਰੇ ਲਈ ਇਹ ਇੱਕ ਨਮੂਨੇ ਉਤਾਰਨ ਦਾ ਸਾਧਨ ਬਣ ਗਿਆ ਹੈ ਮੈਂ ਬੱਚਿਆਂ ਦੇ ਸਵੈਟਰ ਜਿਸ ਤਰ੍ਹਾਂ ਮਰਜ਼ੀ ਬੁਣਾਂ ਮੈਂ ਸਭ ਉਹਨਾਂ ਤੋਂ ਹੀ ਸਿੱਖ ਕੇ ਬਣਾਉਣੀ ਹਾਂ ਹੁਣ ਮੈਨੂੰ ਆਪਣੇ ਪੁਰਾਣੇ ਡਿਜਾਈਨ ਵੀ ਪਾਣੇ ਨਹੀਂ ਪੈਂਦੇ ਉਹ ਨਮੂਨੇ ਇੰਨੇ ਸੋਹਣੇ ਔਰ ਇੰਨੇ ਸਟੀਕ ਹੁੰਦੇ ਨੇ ਕਿ ਮੈਨੂੰ ਕੋਈ ਤੰਗੀ ਨਹੀਂ ਆਉਂਦੀ ਇਸ ਲਈ ਮੈਂ ਉਹਨਾਂ ਕੋਲੋਂ ਹੀ ਸਭ ਕੁਛ ਸਿੱਖਣਾ ਚਾਹੁੰਦੀ ਹਾਂ ਮੈਂ ਕਿੰਨੀ ਵਾਰੀ ਬਾਰ ਬਾਰ ਵੀ ਉਹਨਾਂ ਤੋਂ ਦੇਖ ਲੈਨੀ ਹਾਂ ਤਾਂ ਬਣਾ ਲੈਨੀ ਹਾਂ ਤਾ ਕਿ ਹਰ ਨਾਪ ਦਾ ਸਵੈਟਰ ਬੁਣ ਸਕਾਂ ਹੁਣ ਹੋਰ ਸਵੈਟਰ ਬੁਣਨ ਲਈ ਵੀ ਮੈਂ ਇਹਨਾਂ ਆਨਲਾਈਨ ਤੋਂ ਹੀ ਸਿੱਖਿਆ ਕਰੂੰਗੀ ਤਾਂ ਕਿ ਮੈਨੂੰ ਕੁਛ ਵੀ ਕਰਨ ਦੀ ਮੁਸ਼ਕਿਲ ਨਾ ਆਵੇ ਮੈਨੂੰ ਇਹ ਬੜਾ ਸਹਾਇਤਾ ਮਿਲ ਜਾਂਦੀ ਹੈ ਕਿ ਮੈਂ ਹਰ ਤਰ੍ਹਾਂ ਦਾ ਕੰਮ ਇਹਨਾਂ ਲੋਕਾਂ ਕੋਲੋਂ ਲੈ ਸਕਦੀ ਹਾਂ